ਗਿਆਨ ਅਤੇ ਟੈਕਨੋਲਜੀ ਨੇ ਮਹਾਂਮਾਰੀ ਦੌਰਾਨ ਇਹਦੇ ਮਹਾਂਮਾਰੀ ਦੌਰਾਨ ਲੋਕਾਂ ਦੇ ਧਿਆਨ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ ਹੈਗੀ ਹੈ ਵੈਸੇ ਵੀ ਜਿੱਦਾਂ ਜਿਹੜੀ ਵਿਗਿਆਨ ਅਤੇ ਟੈਕਨੋਲਜੀ ਆ ਲੋਕਾਂ ਦੇ ਜੀਵਨ ਵਿੱਚ ਇੱਕ ਅਹਿਮ ਰੋਲ ਅਦਾ ਕਰਦੀ ਹੈਗੀ ਹੈ ਜਿਹੜੀ ਇਹਦਾ ਜਿਹੜਾ ਮੇਨ ਰੋਲ ਆ ਜਿੱਦਾਂ ਹੁਣ ਆਪਾਂ ਪਿੱਛੇ ਜਿਹੇ ਦੇਖਿਆ ਜਾਵੇ ਜਿਹੜਾ ਕੋਵਿਡ ਨਾਈਨਟੀਨ ਦੇ ਦੌਰਾਨ ਇਹਦੇ ਵਿੱਚ ਜਿਹੜਾ ਮੇਨ ਰੋਲ ਹੈ ਇਹਨੇ ਅਦਾ ਕੀਤਾ ਹੈਗਾ ਜਿੱਦਾਂ ਹੁਣ ਮੰਨ ਲਉ ਕੋਈ ਬਿਮਾਰੀ ਫੈਲਦੀ ਹੈਗੀ ਹੈ ਉਹਦਾ ਵਾਇਰਸ ਕਿਵੇਂ ਕਿਸ ਤਰ੍ਹਾਂ ਦਾ ਸੀਗਾ ਉਹਦੇ ਕਿਆ ਉਹਦੇ ਸਿਗਨੀਫਿਕੈਂਸ ਹੋ ਸਕਦੇ ਹੈ ਕਿਆ ਉਹਦੇ ਨੁਕਸਾਨ ਹੈਗੇ ਹੈ ਕਿੱਦਾਂ ਉਹਨੂੰ ਮਾਰਿਆ ਜਾ ਸਕਦਾ ਹੈ ਕਿਹੜੀਆਂ ਚੀਜ਼ਾਂ ਸਾਡੇ ਫਾਇਦੇ ਵਾਸਤੇ ਹੈਗੀਆਂ ਹੈ ਕਿਸ ਤਰ੍ਹਾਂ ਨਾਲ ਕਿਹਦ ਕਿਹੜੀ ਚੀਜ਼ਾਂ ਨਾਲ਼ ਆਪਾਂ ਕਿਹੜੀ ਚੀਜ਼ਾਂ ਖਾ ਸਕਦੇ ਹੈਗੇ ਹੈ ਜਿਨ੍ਹਾਂ ਨਾਲ਼ ਮਤਲਬ ਵਾਇਰਸ ਦਾ ਆਪਾਂ ਨਜਿੱਠਿਆ ਜਾ ਸਕਦਾ ਆਪਾਂ ਵ ਦਵਾਈ ਤੋਂ ਮਤਲਬ ਆ ਮੈਡੀਸਨ ਤੋਂ ਬਿਨਾਂ ਹੀ ਉਹਨੂੰ ਖਤਮ ਕਰ ਸਕਦੇ ਹੈਗੇ ਹੈ ਇਸ ਤਰ੍ਹਾਂ ਮਤਲਬ ਕਾਫੀ ਇਹਦੇ ਵਿੱਚ ਜਿਹੜੀ ਵਿਗਿਆਨਕ ਟੈਕਨੋਲਜੀ ਮਹਾਂਮਾਰੀ ਦੇ ਦੌਰਾਨ ਇਸ ਤਰ੍ਹਾਂ ਉਹਨੇ ਟੈਕਨੋਲਜੀ ਨੇ ਕਾਫੀ ਤਰ੍ਹਾਂ ਮਦਦ ਕੀਤੀ ਹੈਗੀ ਹੈ ਸਾਡੇ ਸਾਰਿਆਂ ਲੋਕਾਂ ਦੀ